ਹਾਂਜੀ ਸਤਿ ਸ਼੍ਰੀ ਅਕਾਲ ਆਂਟੀ ਜੀ ਹਾਂਜੀ ਹਾਂਜੀ ਤੁਸੀਂ ਦੱਸੋ ਜੀ ਸਾਰਾ ਘਰ ਬਾਰ ਠੀਕ ਹੈ ਜੀ ਹਾਂਜੀ ਹਾਂਜੀ ਮਾਲਕ ਦੀ ਕਿਰਪਾ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਕਿਹਾ ਥੋਨੂੰ ਨਾ ਬੈਸਟ ਦੱਸਦਾ ਬੈਸਟ ਦਾ ਇਹ ਹੀ ਐ ਜੀ ਤੁਸੀਂ ਨਾ ਬੱਸ ਰਾਹੀਂ ਆਓ ਕਿਉਂਕਿ ਨੋਨ ਸਟੋਪ ਬੱਸਾਂ ਚੱਲ ਰਹੀਆਂ ਵੈਸੇ ਹੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪੰਜਾਬ ਅਤੇ ਦਿੱਲੀ ਵਿੱਚ ਆਧਾਰ ਕਾਰਡ ਹੀ ਚੱਲ ਰਿਹਾ ਲੇਡੀਜ ਦਾ ਨਾਲ ਤੁਹਾਡਾ ਪੈਸੇ ਦੀ ਥੋੜ੍ਹੀ ਬਚਤ ਹੋ ਜੂਗੀ ਤੁਸੀਂ ਨੌਨ ਸਟੋਪ ਬਸ ਸਿੱਧੀ ਲੁਧ ਲੁਧਿਆਣੇ ਤੋਂ ਅਬੋਹਰ ਵਾਲੀ ਬੱਸ ਫੜ ਲਓ ਜੀ ਅਬੋਹਰ ਜਾਂਦੀ ਹੈ ਪਹਿਲਾਂ ਹਾਂਜੀ ਉਹ ਮੁਕਤਸਰ ਆਉਂਦੀ ਹੈਗੀ ਉਹ ਸਭ ਤੋਂ ਪਹਿਲਾਂ ਤਾਂ ਉੱਥੇ ਮੋਗੇ ਮੋਗੇ ਤੋਂ ਬਾਅਦ ਬਾਘਾ ਪਰਾਣਾ ਬਾਘੇ ਪੁਰਾਣੇ ਤੋਂ ਬਾਅਦ ਇੱਥੇ ਆਉਂਦੀ ਆ ਆਪਣੇ ਕੋਟ ਹਾਂਜੀ ਕੋਟ ਤੋਂ ਬਾਅਦ ਮੁਕਤਸਰ ਹਾਂਜੀ ਜਿਹੜੀ ਤੁਸੀਂ ਦੂਜੀ ਬੱਸ ਫੜੋਗੇ ਉਹ ਰੁਕ ਰੁਕ ਕੇ ਆਉਂਦੀ ਹੈ ਕਿਉਂਕਿ ਇਹ ਬੱਸ ਜਿਹੜੀ ਆ ਇਹ ਅੱਡਿਆਂ 'ਚ ਥੋੜ੍ਹਾ ਜਿਹਾ ਟਾਈਮ ਰੁਕ ਕੇ ਥੋੜ੍ਹਾ ਜਿਹਾ ਟਾਈਮ ਹੀ ਰੁਕਦੀ ਆ ਬਾਕੀ ਨਹੀਂ ਤਾਂ ਸਿੱਧੀ ਚੱਲੀ ਜਾਂਦੀ ਸਿੱਧੀ ਮੇਨ ਮੇਨ ਅੱਡਿਆਂ 'ਤੇ ਹਾਂਜੀ ਮੁਕਤਸਰ ਉਤਰਨ ਦੇ ਸਾਰ ਤੁਸੀਂ ਬਸ ਸਟੈਂਡ ਦੇ ਉੱਤੇ ਜਾ ਤੁਰ ਕੇ ਹੀ ਜਾ ਸਕਦੇ ਜਾਂ ਰਿਕਸ਼ੇ 'ਤੇ ਵੀ ਜਾ ਸਕਦੇ ਹਾਂ ਅਲੱਗ ਅਲੱਗ ਨੰਬਰ ਗੇਟ ਬਣੇ ਵੇ ਆ ਆਪਣੇ ਗੁਰਦੁਆਰਾ ਸਾਹਿਬ ਦੇ ਹਾਂਜੀ ਹਾਂਜੀ ਬਾਕੀ ਜੇ ਤੁਸੀਂ ਟ੍ਰੇਨ 'ਤੇ ਆਉਣਾ ਤਾਂ ਲੁਧਿਆਣੇ ਤੋਂ ਸਿੱਧਾ ਪਹਿਲਾਂ ਬਠਿੰਡੇ ਜਾਣਾ ਪਊਗਾ ਮੁਕਤਸਰ ਨੂੰ ਕਿਉਂਕਿ ਜੇ ਤੁਸੀਂ ਮੁਕਤਸਰ ਸਿੱਧਾ ਆਉਣਾ ਫਿਰ ਤੁਹਾਡੇ ਥੋੜ੍ਹਾ ਜਿਹਾ ਟਾਈਮ ਲੱਗੂਗਾ ਕਿਉਂਕਿ ਟਾਈਮ ਜ਼ਿਆਦਾ ਕੁ ਘੁੰਮ ਕੇ ਆਉਂਦੀ ਹੈ ਟਰੇਨ ਜੇ ਤੁਸੀਂ ਉਥੇ ਮੁਕਤਸਰ ਟ੍ਰੇਨ 'ਤੇ ਆਉਂਗੇ ਪਹਿਲਾਂ ਬਠਿੰਡਾ ਬਠਿੰਡੇ ਤੋਂ ਬਾਅਦ ਫਿਰ ਤੁਹਾਨੂੰ ਬਾ ਬਸ ਬਦਲਣੀ ਪਊਗੀ ਹਾਂਜੀ ਮੈਂ ਕਹਿੰਦਾ ਤੁਸੀਂ ਇੱਧਰ ਸਿੱਧੀ ਡਾਇਰੈਕਟ ਬਸ ਫੜ ਲਿਓ ਜੀ ਹਾਂਜੀ ਗੁਰੂ ਗੁਰੂ ਘਰ ਦੇ ਵਿੱਚ ਆਧਾਰ ਕਾਰਡ 'ਤੇ ਨਵਾਂ ਦੇ ਦਿੰਦੇ ਹੈ ਜੀ ਰੂਮ ਦੇ ਮਿਲ ਜਾਂਦਾ ਹਾਂਜੀ ਬਾਕੀ ਸਾਰੀਆਂ ਸੁਵਿਧਾ ਵਿੱਚ ਹੈਗੀਆਂ ਜੀ ਸੰਗਤ ਲਈ ਹਾਂਜੀ ਤੁਸੀਂ ਜ਼ਰੂਰ ਆਇਓ ਜੀ ਇੱਕ ਵਾਰੀ ਤੁਸੀਂ ਇੰਨਾ ਇਤਿਹਾਸਕ ਗੁਰਦੁਆਰਾ ਆਪਣਾ ਜ਼ਰੂਰ ਮੱਥਾ ਟੇਕਣਾ ਜੇ ਬਾਕੀ ਵਧੀਆ ਦਾ ਬੱਸ ਦੇ ਹਾਂਜੀ ਹਾਂਜੀ ਜ਼ਰੂਰ ਦੇ ਦੇਵਾਂਗੇ ਜੀ ਬਾਕੀ ਇੱਥੇ ਮੁਕਤ ਮੀਨਾਰ ਬਣੇ ਵੇ ਹੈ ਆਪਣਾ ਉੱਥੇ ਵੀ ਘੁੰਮ ਲਿਓ ਜੇ ਹੋਰ ਵੀ ਬਹੁਤ ਵਧੀਆ ਹੈ ਜਗ੍ਹਾ ਹੈ ਨਾ ਬਾਕੀ ਇੱਥੇ ਜੁੱਤੀ ਆਪਣੀ ਜੁੱਤੀ ਵੀ ਬਹੁਤ ਫੇਮਸ ਹੋਈ ਮੁਕਤਸਰ ਦੀ ਉਹ ਵੀ ਤੁਸੀਂ ਖਰੀਦ ਲਿਓ ਜੀ

ਹਾਂ ਹਾਂਜੀ ਹਾਂਜੀ ਤੁਸੀਂ ਮਾਘੀ ਵੇਲੇ ਆਉਂਗੇ ਜੀ ਠੀਕ ਹੈ ਜੀ ਬਸ ਬਸ 'ਤੇ ਆਓ ਜੇ ਵਧੀਆ ਪਹੁੰਚ ਜਾਉਂਗੇ ਨਾਲ ਛੇਤੀ ਟਾਈਮ ਤੁਹਾਡੀ ਬੱਚਤ ਹੋ ਜਾਉ ਟਾਈਮ ਦੀ ਡਾਰੈਕਟ ਕਹਿ ਦਿਓ ਬੈਸਟ ਮੁਕਤਸਰ ਦੀ ਟਿਕਟ ਕਟਾ ਲਓ ਜੀ ਲੁਧਿਆਣੇ ਤੋਂ ਹਾਂਜੀ ਜੇ ਪੈਦਲ ਜੇ ਪੈਦਲ ਜਾ ਸਕਦੇ ਪੈਦਲ ਵੀ ਥੋੜ੍ਹਾ ਥੋੜ੍ਹੀ ਜਿਹੀ ਦੂਰ ਆ ਇੰਨਾ ਕੋਈ ਖ਼ਾਸ ਜ਼ਿਆਦਾ ਦੂਰ ਨਹੀਂ ਕਿਉਂਕਿ ਨਾਲ ਨਾਲ ਗੇਟ ਬਣੇ ਵੇ ਹੈ ਠੀਕ ਹੈ ਜੀ ਧੰਨਵਾਦ ਜ਼ਰੂਰ ਆਓ ਜੀ ਠੀਕ ਹੈ ਜੀ ਧੰਨਵਾਦ